ਭਾਰਤ ਦੇ ਵਿੱਚ ਬਹੁਤ ਹੀ ਜ਼ਿਆਦਾ ਡਾਂਸ ਅਤੇ ਸਟਾਈਲ ਹੈਗੇ ਆ ਜਿਵੇਂ ਕਿ ਹਰ ਸਟੇਟ ਦਾ ਆਪਣਾ ਵੱਖਰਾ ਹੀ ਰੁਤਬਾ ਹੈ ਆਪਣਾ ਵੱਖਰੇ ਸਟਾਈਲ ਹੈ ਡਾਂਸ ਦਾ ਨਾਚ ਸ਼ੈਲੀ ਦਾ ਅਤੇ ਇਸ ਨਾਚ ਸ਼ੈਲੀ ਵਿੱਚ ਹਰ ਰਾਜ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਅਪਣਾਏ ਜਾਂਦੇ ਆ ਜਿਵੇਂ ਕਿ ਆਪਾਂ ਵੇਖਦੇ ਹਾਂ ਪੰਜਾਬ ਦੇ ਵਿੱਚ ਸਾਡੇ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਲੋਕਪ੍ਰੀਏ ਅਤੇ ਬਹੁਤ ਜ਼ਿਆਦਾ ਵਧੀਆ ਪ ਨਾਚ ਹੈਗਾ ਭੰਗੜਾ ਇਹਦੇ ਨਾਲ ਨਾ ਸਾਡੇ ਪੰਜਾਬ ਦੇ ਵਿੱਚ ਜਿਵੇਂ ਗਿੱਧਾ ਕੀਤਾ ਜਾਂਦਾ ਮਲਵਈ ਭੰਗੜਾ ਹੋ ਗਿਆ ਦੁਆਬੇ ਦਾ ਹੋ ਗਿਆ ਅਤੇ ਇਸੇ ਤਰੀਕੇ ਨਾਲ ਬਾਕੀ ਜਿਵੇਂ ਆਪਾਂ ਹਿਮਾਚਲ ਦੇ ਵਿੱਚ ਵੇਖਦੇ ਹਾਂ ਉਹ ਲੁੱਡੀ ਕਰਦੇ ਆ ਅਤੇ ਕੰਨੜ ਵਾਲੇ ਸਾਈਡ ਦੇ ਆਪਣੇ ਹਿਸਾਬ ਨਾਲ ਕਰਦੇ ਆ ਅਤੇ ਮਨੀਪੁਰ ਦੇ ਆਪਣਾ ਉਹਨਾਂ ਦਾ ਵੱਖਰਾ ਹੀ ਹੈਗਾ ਨਾਚ ਦਾ ਤਰੀਕਾ ਅਤੇ ਹਰ ਬੰਦਿਆਂ ਦੇ ਆਪਣੇ ਵੱਖਰੇ ਵੱਖਰੇ ਗਾਣੇ ਵੀ ਹੈਗੇ ਆ ਇਸ ਕਰਕੇ ਇਹ ਕਹਿ ਲਓ ਕਿ ਬਹੁਤ ਹੀ ਵਧੀਆ ਅਤੇ ਬਹੁਤ ਹੀ ਫੇਮਸ ਮਸ਼ਹੂਰ ਨੇ ਭਾਰਤ ਦੇ ਵਿੱਚ ਅਤੇ ਇਹ ਸਾਰੇ ਲੋਕਾਂ ਦੇ ਜੀਵਨ ਨਾਲ ਬਹੁਤ ਜੁੜੇ ਹੋਏ ਆ ਬਹੁਤ ਡੂੰਘਾ ਅਸਰ ਆ ਉਹਨਾਂ ਦੀ ਜ਼ਿੰਦਗੀ ਦੇ ਨਾਲ ਕਿਉਂਕਿ ਜਦ ਇਹ ਕਿਸੇ ਵੀ ਸਟਾਈਲ ਦਾ ਜਾਂ ਕਿਸੇ ਵੀ ਸੋਰੀ ਸਟੇਟ ਦਾ ਡਾਂਸ ਭੰਗੜਾ ਕੁਝ ਵੀ ਹੁੰਦਾ ਨਾਚ ਹੁੰਦਾ ਹੈ ਲੋਕ ਤਾਂ ਖੁਸ਼ ਰਹਿੰਦੇ ਆ ਜਿਹਦੇ ਕਰਕੇ ਉਹਨਾਂ ਨੂੰ ਆਪਣਾ ਅੰਦਰੋਂ ਜਿਹੜਾ ਪਾਵਰ ਉਹ ਦਿਖਾਉਣ ਨੂੰ ਮੌਕਾ ਮਿਲਦਾ ਅਤੇ ਭਾਰਤ ਦੇ ਬਹੁਤ ਵਧੀਆ ਵਧੀਆ ਡਾ ਨਾਚ ਸ਼ੈਲੀ ਦੇ ਹੋਏ ਨੇ ਕਲਾਕਾਰ ਮਸਹੂਰ ਡਾਂਸਰ ਹੋਏ ਨੇ ਜਿਵੇਂ ਅੱਜ ਕੱਲ੍ਹ ਦੇ ਹਿਸਾਬ ਨਾਲ ਆਪਾਂ ਦੇਖਿਆ ਜਾਵੇ ਅਤੇ ਸਾਡੇ ਰੈਮੁ ਡਿਸ਼ੂਜਾ ਹੋ ਗਏ ਧਰਮੇਸ਼ ਸਰ ਹੋ ਗਏ ਤੇ ਰਾਘਵ ਹੋ ਗਿਆ ਇਹ ਬਹੁਤ ਹੀ ਵਧੀਆ ਉੱਗਦੇ ਹੋਏ ਸਿਤਾਰੇ ਨੇ ਜਿਹਨਾਂ ਨੇ ਪੂਰੇ ਦੁਨੀਆਂ ਦੇ ਵਿੱਚ ਆਪਣੇ ਦੇਸ਼ ਦਾ ਆਪਣੇ ਆਪਣੇ ਆਪਣੇ ਰਾਜ ਦਾ ਨਾਮ ਰੌਸ਼ਨ ਕੀਤਾ ਏ ਨਾਚ ਸ਼ੈਲੀ ਵਿੱਚ ਆ ਕੇ ਇਸੇ ਤਰੀਕੇ ਨਾਲ ਤੁਹਾਡੇ ਪਹਿਲਾਂ ਦੇ ਜਿਹੜੇ ਬਜ਼ੁਰਗ ਸੀਗੇ ਬਹੁਤ ਵਧੀਆ ਵਧੀਆ ਕਲਾਸੀਕਲ ਦੇ ਡਾਂਸਰ ਸੀਗੇ ਜਾਂ ਕੋਈ ਹੋਰ ਵੀ ਬਹੁਤ ਜ਼ਿਆਦਾ ਵਧੀਆ ਸੀਗੇ